ਹਾਂਜੀ ਸਤਿ ਸ਼੍ਰੀ ਅਕਾਲ ਜੀ ਹਾਂਜੀ ਹਾਂਜੀ ਹਾਂਜੀ ਜੀ ਜੀ ਹਾਂਜੀ ਹਾਂਜੀ ਅੱਛਾ ਜੀ ਅਸੀਂ ਅਸੀਂ ਤੁਹਾਨੂੰ ਕਿਹਾ ਸੀ ਕਿ ਘਰ ਦਾ ਖਾਣਾ ਖਾਣਾ ਏ ਤੁਸੀਂ ਉਹ ਖਾ ਰਹੇ ਹੋ ਜੀ ਤਲਿਆ ਬਿਲਕੁਲ ਬੰਦ ਹੈ ਹਾਂਜੀ ਹਾਂਜੀ ਅੱਛਾ ਜੀ ਕੋਈ ਗੱਲ ਨਹੀਂ ਤੁਸੀਂ ਹਲੇ ਦਵਾਈ ਕੋਂਟੀਨਿਊ ਰੱਖੋ ਅਤੇ ਆਪਣਾ ਖਾਣ ਪੀਣ 'ਤੇ ਪ੍ਰਹੇਜ਼ ਰੱਖੋ ਘਰ ਦਾ ਖਾਣਾ ਖਾਓ ਸਿੰਪਲ ਬਾਹਰ ਦੀ ਕੋਈ ਚੀਜ਼ ਨਹੀਂ ਖਾਣੀ ਜੀ

ਜੀ ਤੁਸੀਂ ਉਹ ਟੈਸਟ ਕਰਾ ਲਿਆ ਕੋਈ ਗੱਲ ਨਹੀਂ ਤੁਸੀਂ ਐਂ ਕਰਿਓ ਕੱਲ੍ਹ ਸ਼ਾਮੀ ਪੰਜ ਵਜੇ ਆਪਣੀਆਂ ਰਿਪੋਰਟਾਂ ਲੈ ਕੇ ਆ ਜਿਓ ਅਤੇ ਆਪਣੀ ਦਵਾਈਆਂ ਵੀ ਲੈ ਆਈਓ ਜੇ ਕੋਈ ਦਵਾਈ ਬਦਲਣੀ ਹੋਈ ਅਸੀਂ ਉਦੋਂ ਦੇਖ ਲਾਂਗੇ ਹੁਣ ਤੁਸੀਂ ਘੰਟੇ ਘੰਟੇ ਬਾਅਦ ਹੀ ਰੱਖੋ

ਕੋਈ ਗੱਲ ਨਹੀਂ ਜੀ